ਟੈਕਨੋਲਜੀ ਕਰਕੇ ਜਿਹੜੀ ਲੋਕਾ ਚਾ ਆਪਸ 'ਚ ਗੱਲਬਾਤ ਆ ਥੋੜ੍ਹੀ ਘੱਟ ਗਈ ਹੈ ਕਿਉਂਕਿ ਲੋਕ ਇੱਕ ਦੂਜੇ ਨੂੰ ਫੋਨ ਰਾਹੀਂ ਜਾਂ ਤਾਂ ਮੈਸੇਜ ਭੇਜ ਦਿੰਦੇ ਹੈ ਜਾਂ ਫੋਨ 'ਤੇ ਹੀ ਗੱਲ ਕਰ ਲੈਂਦੇ ਆ ਆਪਸ 'ਚ ਮਿਲ ਜੁਲ ਕੇ ਗੱਲਬਾਤ ਥੋੜ੍ਹੀ ਘੱਟ ਗਈ ਹੈ ਪਰ ਇਹਦੇ ਨਾਲ ਹੀ ਜਿਹੜਾ ਗੱਲਬਾਤ ਕਰਨ ਦਾ ਸਮੇਂ ਹੁੰਦਾ ਹੈ ਉਹ ਥੋੜ੍ਹਾ ਘੱਟ ਗਿਆ ਹੈ ਕਿਉਂਕਿ ਪਹਿਲਾਂ ਇੱਕ ਦੂਜੇ ਨੂੰ ਗੱਲਬਾਤ ਕਰਨ ਲਈ ਜਾਂ ਤਾਂ ਚਿੱਠੀ ਲਿਖਣੀ ਪੈਂਦੀ ਸੀ ਜਾਂ ਜਾ ਕੇ ਮਿਲਣਾ ਪੈਂਦਾ ਸੀ ਹੁਣ ਤੁਸੀਂ ਘਰ ਬੈਠੇ ਹੀ ਕਦੇ ਵੀ ਕਿਤੇ ਵੀ ਕਿਸੇ ਦੂਜੇ ਬੰਦੇ ਨਾਲ ਗੱਲ ਕਰ ਸਕਦੇ ਹੋ ਜਿਹਦੇ ਕਰਕੇ ਕਿਸੇ ਹੋਰ ਨੂੰ ਕੋਈ ਗੱਲ ਪਹੁੰਚਾਉਣੀ ਸੌਖੀ ਹੋ ਗਈ ਹੈ ਇਹਦੇ ਨਾਲ ਹੀ ਨਾਲ ਸੋਸ਼ਲ ਮੀਡੀਆ ਦੇ ਇਜਾਦ ਨਾਲ ਭਾਵੇਂ ਇੱਕ ਦੂਜੇ ਨਾਲ ਦੇ ਨਾਲ ਮਿਲਣਾ ਗੱਲਬਾਤ ਕਰਨੀ ਸੌਖੀ ਹੋ ਗਈ ਹੈ ਪਰ ਲੋਕ ਸੋਸ਼ਲ ਮੀਡੀਆ 'ਤੇ ਦਿਖਾਵਾ ਕਰਨਾ ਜ਼ਿਆਦਾ ਪਸੰਦ ਕਰਦੇ ਹਨ ਜਿਹਦੇ ਕਰਕੇ ਸੱਚ ਛੁਪਦਾ ਹੈ ਅਤੇ ਲੋਕ ਸੱਚਾਈ ਤੋਂ ਦੂਰ ਹੁੰਦੇ ਜਾ ਰਹੇ ਨੇ